ਸਤਾਈ ਮਾਰਚ ਦੋ ਹਜ਼ਾਰ ਚੌਵੀ ਚੌਦਾਂ ਅਪ੍ਰੈਲ ਦੋ ਹਜ਼ਾਰ ਚੌਵੀ ਦਸ ਮਈ ਦੋ ਹਜ਼ਾਰ ਚੌਵੀ ਅਠਾਰਾਂ ਜੂਨ ਦੋ ਹਜ਼ਾਰ ਚੌਵੀ ਤੇਈ ਜੂਨ ਦੋ ਹਜ਼ਾਰ ਚੌਵੀ